ਸਕੂਲਾਂ ਵਿੱਚ ਅੱਜ ਕੱਲ੍ਹ ਤਾਂ ਬਹੁਤ ਹੀ ਮ ਅਲੱਗ ਅਲੱਗ ਕਿਸਮ ਦੀਆਂ ਖੇਡਾਂ ਨੇ ਜਿਹੜੀਆਂ ਖੇਡ ਮੁਕਾਬਲੇ ਨੇ ਕੀਤੇ ਜਾਂਦੇ ਨੇ ਅਤੇ ਉਹਨਾਂ ਵਿੱਚ ਭਾਗ ਵੀ ਲਿਆ ਜਾਂਦਾ ਹੈ ਇੰਟਰਨੈਸ਼ਨਲ ਪੱਧਰ 'ਤੇ ਵੀ ਅਤੇ ਜੋਨ ਪੱਧਰ 'ਤੇ ਵੀ ਅਤੇ ਇਹਨਾਂ ਨਾਲ ਬੱਚੇ ਆ ਜਿਹੜੇ ਉਹਨਾਂ ਦਾ ਸਕੂਲਾਂ ਵਿੱਚ ਵੀ ਇੰਟਰਸਟ ਵੱਧ ਗਿਆ ਇਨ੍ਹਾਂ ਖੇਡਾਂ ਵਿੱਚ ਮੁਕਾਬਲੇ ਕਰਵਾਉਣ ਨਾਲ ਅਤੇ ਵੱਖ ਵੱਖ ਤਰ੍ਹਾਂ ਦੀਆਂ ਖੇਡਾਂ ਹੋ ਗਈਆਂ ਜਿਵੇਂ ਕਬੱਡੀ ਦਾ ਮੈਚ ਹੋ ਗਿਆ ਵੋਲੀਬਾਲ ਦਾ ਹੋ ਗਿਆ ਬੈਡਮਿੰਟਨ ਦਾ ਹੋ ਗਿਆ ਇਹ ਇਸ ਤੋਂ ਇਲਾਵਾ ਹੋਰ ਵੀ ਕਈ ਖੇਡਾਂ ਨੇ ਜਿਨ੍ਹਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਨੇ ਅਤੇ ਇਹ ਨਾ ਇੱਕ ਖੇਡਾਂ ਨੇ ਨਾ ਜਿਹੜੀਆਂ ਉਹ ਸਾਡੇ ਇੱਕ ਤਾਂ ਸਰੀਰ ਦੀ ਫਿਟਨੈਸ ਲਈ ਸਹੀ ਤਾਂ ਹੈ ਸਹੀ ਨੇ ਸੈਕਿੰਡਲੀ ਦੂਜਾ ਕੀ ਹੈ ਕਿ ਇਹਨਾਂ ਨਾਲ ਨਾ ਬੱਚਿਆਂ ਦੇ ਕਰੀਅਰ 'ਚ ਬੜਾ ਅੱਛਾ ਵਧੀਆ ਰੋਲ ਨਿਭਾ ਰਹੀਆਂ ਨੇ ਇਹ ਮੁਕਾਬਲੇ ਕਰਵਾਉਣ ਨਾਲ ਇੱਕ ਤਾਂ ਬੱਚਾ ਇਨਾਮ ਜਿੱਤਦਾ ਜੋਨ ਲੈਵਲ 'ਤੇ ਇੰਟਰਨੈਸ਼ਨਲ ਲੈਵਲ 'ਤੇ ਜਾਂਦਾ ਅਤੇ ਬੱਚੇ ਜਿਹੜੇ ਨੇ ਇਹ ਨਾ ਅੱਗੇ ਸਾਡੇ ਕਰੀਅਰ ਵਿੱਚ ਵੀ ਬਹੁਤ ਜ਼ਿਆਦਾ ਸਾਨੂੰ ਹੈਲਪਫੁਲ ਨੇ ਅਤੇ ਮੈਂ ਅੱਜ ਤੱਕ ਦੌੜਾਂ 'ਚ ਭਾਗ ਲਿਆ ਅਤੇ ਜਦੋਂ ਮੈਂ ਕਾਫੀ ਇੰਟਰਸਟਿਡ ਰਹਿੰਦੀ ਹਾਂ ਦੌੜਾ 'ਚ ਖੇ ਇਸ 'ਚ ਅਤੇ ਮੈਂ ਇਸ ਤੋਂ ਇਲਾਵਾ ਕਿਸੇ ਅੱਗੇ ਜੋਨ ਪੱਧਰ ਤੱਕ ਕਦੇ ਵੈਸੇ ਖੇਡਣ ਨਹੀਂ ਗਈ ਕਿਉਂਕਿ ਸਾਡੇ ਟਾਈਮ 'ਤੇ ਇੰਨੀਆਂ ਖੇਡਾਂ ਹੈ ਨਹੀਂ ਸੀ ਸਾਡੇ ਸਕੂਲ ਅਤੇ ਬਸ ਇਹੀ ਕਹਿਣਾ ਚਾਹੁੰਦੀ ਹਾਂ ਕਿ ਖੇਡਾਂ ਮੁਕਾਬਲੇ ਅੱਜ ਦੇ ਦੌਰ 'ਚ ਬੜਾ ਹੀ ਵਧੀਆ ਸਾਧਨ ਨੇ ਜੋ ਆਪਣੇ ਕਰੀਅਰ ਨੂੰ ਬਣਾਉਣ 'ਚ ਵੀ ਹੈਲਪ ਕਰਦੀਆਂ ਨੇ